ਬਾਹਰੋਂ ਆਉਣ ਵਾਲੇ ਸੈਲਾਨੀ ਜੋ ਕਿ ਸਾਡੇ ਰਾਜ ਦੀ ਕੁਦਰਤੀ ਸੰਨਤਤਾ ਦਾ ਅਨੁਭਵ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇੱਥੇ ਬਹੁਤ ਵਿਕਲਪ ਹਨ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਨੇੜੇ ਅਟਾਰੀ ਬੋਡਰ ਅਟਾਰੀ ਬੋਡਰ ਦੇ ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਜਵਾਨਾਂ ਦੁਆਰਾ ਰੋਜ਼ ਰੀਟਰੀਟ ਸੈਰੇਮਨੀ ਮਨਾਈ ਜਾਂਦੀ ਹੈ ਜਿਸ ਨੂੰ ਦੇਖਣ ਲਈ ਭਾਰੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਲੋਕ ਅਤੇ ਹਿੰਦੁਸਤਾਨ ਦੇ ਲੋਕ ਇੱਕ ਜਗ੍ਹਾ ਇਕੱਠੇ ਹੁੰਦੇ ਹਨ ਇਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਬਹੁਤ ਹੀ ਦੇਸ਼ ਦੇ ਨਾਲ ਜਜ਼ਬੇ ਨਾਲ ਭਰੇ ਹੋਏ ਲੋਕ ਇੱਥੇ ਇਕੱਠੇ ਹੁੰਦੇ ਹਨ ਇਸ ਤੋਂ ਇਲਾਵਾ ਕੁਦਰਤੀ ਸੁੰਦਰਤਾ ਦੇਖਣ ਦੇ ਲਈ ਤਰਨ ਤਾਰਨ ਤੋਂ ਪੱਚੀ ਤੋਂ ਤੀਹ ਕਿਲੋਮੀਟਰ ਦੀ ਦੂਰੀ 'ਤੇ ਹਰੀਕੇ ਦਰਿਆ ਉੱਤੇ ਇੱਕ ਬਹੁਤ ਹੀ ਸੋਹਣੀ ਝੀਲ ਹੈ ਜਿੱਥੇ ਕਿ ਪੂਰੀ ਦੁਨੀਆ ਤੋਂ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਇੱਥੇ ਆਪਣਾ ਬਸੇਰਾ ਬਣਾਉਣ ਲਈ ਆਉਂਦੇ ਹਨ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਜੀਵ ਅਤੇ ਹੋਰ ਪੰਛੀ ਵਗੈਰਾ ਇੱਕ ਜ਼ੂ ਬਣਾਇਆ ਗਿਆ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਹੁੰਦੇ ਹਨ ਇੱਥੋਂ ਦਾ ਨਜ਼ਾਰਾ ਬਹੁਤ ਸ਼ਾਂਤ ਅਤੇ ਰੰਗ ਬਰੰਗੇ ਬੂਟਿਆਂ ਦੇ ਨਾਲ ਪੌਂਦਿਆਂ ਦੇ ਨਾਲ ਭਰਿਆ ਹੋਇਆ ਹੁੰਦਾ ਹੈ ਜਿੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਕੁੰਦਰਤੀ ਕੁਦਰਤੀ ਸੁੰਦਰਤਾ ਨੂੰ ਦੇਖਣ ਦਾ ਅਲੱਗ ਹੀ ਨਜਰੀਆ ਹੈ